ਮੈਂ ਰੰਗਾਂ ਨੂੰ ਰੰਗਣ ਵਾਸਤੇ ਕਈ ਮਾਧਿਅਮ ਦੀ ਵਰਤੋਂ ਕਰਦੀ ਹਾਂ ਜਿਸ ਵਿੱਚ ਪਾਣੀ ਵਾਲੇ ਰੰਗ ਆ ਗਏ ਕਰੇਔਨਸ ਆ ਗਏ ਪੈੱਨਸਿਲ ਕਲਰ ਆ ਗਏ ਜਾਂ ਅਸੀਂ ਡਿਫ ਜਿਹੜੇ ਅਲੱਗ ਅਲੱਗ ਤਰ੍ਹਾਂ ਦੀਆਂ ਪੈੱਨਸਿਲਾਂ ਹੁੰਦੀਆਂ ਉਦੋਂ ਵੀ ਵਰਤੋਂ ਕਰਦੇ ਹਨ ਜਿਵੇਂ ਕਿਸੇ ਦੇ ਅੱਖਾਂ ਬਣਾਉਣੀਆਂ ਅਤੇ ਉਹਦੇ ਵਾਸਤੇ ਅਸੀਂ ਟੈਨ ਬੀ ਪੈੱਨਸਿਲ ਦਾ ਇਸਤੇਮਾਲ ਕਰਦੇ ਹਨ ਪਾਣੀ ਵਾਲੇ ਰੰਗਾਂ ਦਾ ਇਸਤੇਮਾਲ ਬੰਦੇ ਦੇ ਅਸੀਂ ਮੁੱਖ ਦੇ ਜਿਹੜੇ ਐਕਸਪ੍ਰੈਸ਼ਨ ਹੈਗੇ ਨੇ ਜਿਹੜੇੇ ਉਹਦੇ ਭਾਵ ਹੈਗੇ ਨੇ ਉਹਨਾਂ ਨੂੰ ਦਰਸਾਉਣ ਵਾਸਤੇ ਕਰਦੇ ਹਾਂ